ਹੈਲੋ ਹਾਂਜੀ ਹਾਂਜੀ ਹਾਂਜੀ ਲਾ ਦਾਂਗੇ ਜੀ ਅੱਗੇ ਵੀ ਲਗਾਉਂਦੇ ਹਾਂ ਹੁਣ ਵੀ ਲਾ ਦਾਂਗੇ ਹਾਂਜੀ ਹੁਣ ਵੀ ਠੀਕ ਹੈ ਜੀ ਲਗਾ ਦਾਂਗੇ ਜੀ ਅੱਗੇ ਵੀ ਧਿਆਨ ਰੱਖਦੇ ਹਾਂ ਹੁਣ ਵੀ ਰੱਖਿਆ ਕਰਾਂਗੇ ਜੀ ਹਾਂਜੀ ਠੀਕ ਹੈ ਜੀ ਰੱਖਾਂਗੇ ਜੀ ਹਾਂਜੀ ਠੀਕ ਹੈ ਜੀ ਓਕੇ